ਭੰਗੜਾ ਐਰੋਬਿਕਸ ਇੱਕ ਯੋਗ ਨ੍ਰਿਤ ਹੈ ਜਿਸ ਨੂੰ ਭੰਗੜੇ ਦੀ ਤਰਸ 'ਤੇ ਕੀਤਾ ਜਾਂਦਾ ਹੈ ਇਸ ਨਾਲ ਸਰੀਰ ਵਿੱਚ ਐਕਸਰਸਾਈਜ਼ ਨਾਲ ਸਰੀਰ ਦੀ ਐਕਸਰਸਾਈਜ਼ ਹੁੰਦੀ ਰਹਿੰਦੀ ਹੈ ਇਸ ਇਹ ਕਰਨ ਇਸ ਨਾਲ ਸਾਡੇ ਸਰੀਰ ਦੀ ਐਕਸਰਸਾਈਜ਼ ਹੁੰਦੀ ਹੈ ਇਸ ਬਾਰੇ ਅਸੀਂ ਪਹਿਲੀ ਵਾਰ ਆਪਣੇ ਬੱਚਿਆਂ ਦੇ ਸਕੂਲ ਵਿੱਚ ਦੇਖਿਆ ਸੀ ਸੁਣਿਆ ਸੀ ਉਹਨਾਂ ਦੇ ਸਕੂਲ ਵਿੱਚ ਇਹ ਪਰਫੋਰਮੈਂਸ ਕੀਤੀ ਗਈ ਸੀ ਜੋ ਕਿ ਬੱਚੇ ਬੜੀ ਖੁਸ਼ੀ ਨਾਲ ਕਰ ਰਹੇ ਸਨ ਇਸ ਬਾਰੇ ਇਹ ਸਾਡੇ ਇਹ ਸਾਡੇ ਬੱਚਿਆਂ ਦੇ ਸਕੂਲ ਵਿੱਚ ਕੀਤੀ ਗਈ ਇੱਕ ਐਕਟੀਵਿਟੀ ਸੀ ਜਿਸ ਨੂੰ ਕਰਕੇ ਬੱਚੇ ਬਹੁਤ ਖੁਸ਼ ਹੋ ਰਹੇ ਸਨ ਧੰਨਵਾਦ